ਸਤਿ ਸ਼੍ਰੀ ਅਕਾਲ ਜੀ ਅਸੀਂ ਪੱਚੀ ਤਰੀਕ ਨੂੰ ਇੱਕ ਵਨ ਪਲੱਸ ਦਾ ਫੋਨ ਜੋ ਤੁਹਾਡੇ ਸ਼ੋਅਰੂਮ 'ਤੇ ਓਰਡਰ ਕੀਤਾ ਸੀ ਉਹ ਸਾਨੂੰ ਤਕਰੀਬਨ ਦੋ ਤਰੀਕ ਨੂੰ ਸਾਨੂੰ ਮੌਰਨਿੰਗ ਵਿੱਚ ਹੀ ਮਿਲ ਗਿਆ ਜਦੋਂ ਅਸੀਂ ਉਹ ਪੈਕਿੰਗ ਖੋਲ੍ਹੀ ਤਾਂ ਸਾਨੂੰ ਬਾਕਮਾਲ ਬਿਲਕੁਲ ਸਹੀ ਸਲਾਮਤ ਸਾਡਾ ਜੋ ਫੋਨ ਹੈ ਉਹ ਮਿਲਿਆ ਅਸੀਂ ਉਹਨੂੰ ਚਲਾਇਆ ਉਹਦਾ ਬਿਲਕੁਲ ਲੁੱਕ ਬਹੁਤ ਅੱਛੀ ਹੈ ਫਿਚਰ ਅੱਛੇ ਹਨ ਔਰ ਮੇਰੇ ਦਾ ਨਾਲ ਦੇ ਦੋਸਤਾਂ ਨੇ ਔਰ ਫੈਮਿਲੀ ਨੇ ਬੱਚਿਆਂ ਨੇ ਬਹੁਤ ਪਸੰਦ ਕੀਤਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰੀਕੇ ਨਾਲ ਫਿਊਚਰ ਦੇ ਵਿੱਚ ਹਰ ਇੱਕ ਕਸਟਮਰ ਦਾ ਧਿਆਨ ਰੱਖੋਂਗੇ ਔਰ ਸਹੀ ਸਮੇਂ 'ਤੇ ਸਹੀ ਚੀਜ਼ ਪਹੁੰਚਾਉਂਗੇ ਧੰਨਵਾਦ ਜੀ